ਮੈਂ ਮੋਹਾਲੀ ਜ਼ਿਲ੍ਹੇ ਦੇ ਇੱਕ ਪਿੰਡ ਦੀ ਨਿ ਨਿਵਾਸੀ ਹਾਂ ਇੱਥੇ ਬਹੁਤ ਸਾਰੇ ਉਤਪਾਦਾਂ ਦੇ ਸਾਧਨ ਹਨ ਜਿਵੇਂ ਕਿ ਜਿਵੇਂ ਕਿ ਫ਼ਸਲ ਪਸ਼ੂ ਪਾਲਣ ਸਿੰਚਾਈ ਅਤੇ ਤਕਨੋਲੇਜੀ ਜਿਵੇਂ ਕਿ ਫ਼ਸਲਾਂ ਦੀ ਗੱਲ ਕਰੀਏ ਤਾਂ ਇੱਥੇ ਕ ਫ਼ਸਲਾਂ ਵਿੱਚ ਕਣਕ ਜੀਰੀ ਮੱਕੀ ਸਰ ਸਰਸੋਂ ਅਤੇ ਫ਼ਲ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਪਸ਼ੂ ਪਸ਼ੂ ਪਾਲਣ ਵਿੱਚ ਲੋਕ ਆਪਣੇ ਲਈ ਅਤੇ ਜਿਹਨਾਂ ਕੋਲ ਪਸ਼ੂ ਨਹੀਂ ਹੁੰਦੇ ਉਹਨਾਂ ਨੂੰ ਦੁੱਧ ਦਹੀਂ ਵੇਚਣ ਦਾ ਕੰਮ ਵੀ ਕਰਦੇ ਹਨ ਸ ਤਕਨੋਲੇਜੀ ਦੀ ਗੱਲ ਕਰੀਏ ਤਾਂ ਇਸ ਸਮੇਂ ਟਰੈਕਟਰ ਅਤੇ ਬਹੁਤ ਸਾਰੀ ਮਸ਼ੀਨਰੀ ਆ ਗਈ ਹੈ